ਪੰਜਾਬੀ ਤੋਂ ਫਰੈਂਚ ਜਾਂ ਫਰੈਂਚ ਤੋਂ ਪੰਜਾਬੀ ਅਨੁਵਾਦ ਕਰਨ ਵੇਲੇ ਜਦ ਮੈਂ ਆਪਣੇ ਕਾਲਜ ਦੇ ਵਿੱਚ ਪੜ੍ਹਦਾ ਸਾਂ ਤਾਂ ਉਸ ਵੇਲੇ ਮੈਨੂੰ ਇਹ ਇਹਨੂੰ ਅਨੁਵਾਦ ਕਰਨ ਦੀ ਬਹੁਤ ਲੋੜ ਪਈ ਸੀਗੀ ਅਤੇ ਜਿਵੇਂ ਕਿ ਖਾਲੀ ਥਾਵਾਂ ਭਰਨੀਆਂ ਸੰਨਟੈਂਸ ਬ ਬਣਾਉਣੇ ਹੈ ਨਾ ਅਤੇ ਆਪਣੇ ਆਪਣੇ ਅਧਿਆਪਕ ਨਾਲ਼ ਫਰੈਂਚ ਦੇ ਵਿੱਚ ਗੱਲ ਕਰਨਾ ਅਤੇ ਇਨ੍ਹਾਂ ਸਭ ਕੰਮਾਂ ਵੇਲੇ ਮੈਨੂੰ ਪੰਜਾਬੀ ਨੂੰ ਫਰੈਂਚ ਦੇ ਵਿੱਚ ਅਤੇ ਫਰੈਂਚ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਪਿਆ ਤਾਂ ਕਿ ਮੈਂ ਫਰੈਂਚ ਨੂੰ ਵੀ ਸਿੱਖ ਸਕਾਂ ਅਤੇ ਅਨੁਭਵ ਮੇਰਾ ਬਹੁਤ ਵਧੀਆ ਸੀਗਾ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈਨੂੰ ਪੰਜਾਬੀ ਭਾਸ਼ਾ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਫਰੈਂਚ ਭਾਸ਼ਾ ਬਾਰੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਇਹ ਤੋਂ ਇਲਾਵਾ ਜਿੱਥੇ ਅਸੀਂ ਘੁੰਮਣ ਜਾਣਾ ਕਲਕੱਤੇ ਜਾਂ ਦਿੱਲੀ ਤਾਂ ਉੱਥੇ ਜੇ ਜਿਹੜੀ ਉੱਥੇ ਦੀ ਆਮ ਭਾਸ਼ਾਵਾਂ ਨੇ ਜਿਵੇਂ ਬੰਗਲੌਰ ਦੇ ਵਿੱਚ ਬੰਗਾਲੀ ਬੋਲੀ ਜਾਂਦੀ ਹੈ ਮਦਰਾਸ ਦੇ ਵਿੱਚ ਮਦਰਾਸੀ ਬੋਲੀ ਜਾਂਦੀ ਹੈ ਤਾਂ ਇਨ੍ਹਾਂ ਭਾਸ਼ਾ ਨੂੰ ਇਨ੍ਹਾਂ ਭਾਸ਼ਾਵਾਂ ਨੂੰ ਵੀ ਮੈਨੂੰ ਅਨੁਵਾਦ ਕਰਕੇ ਹੈ ਨਾ ਪੰਜਾਬੀ ਦੇ ਵਿੱਚ ਸਮਝਣਾ ਪਿਆ ਅਤੇ ਉਸ ਤੋਂ ਪੰਜਾਬੀ ਨੂੰ ਅਨੁਵਾਦ ਕਰਕੇ ਮੈਨੂੰ ਲੋਕਾਂ ਨੂੰ ਸਮਝਾਉਣਾ ਪਿਆ ਅਤੇ ਇਨ੍ਹਾਂ ਸਭ ਦੇ ਅਨੁਭਵ ਬਹੁਤ ਵਧੀਆ ਸੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਛ ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ